ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਬਸ ਵਧੀਆ ਵਧੀਆ ਔਰ ਕੀ ਕਰਨ ਡੇ ਅੱਛਾ ਅੱਛਾ ਭਾਅ ਜੀ ਇੱਥੇ ਪ੍ਰਾਈਵੇਟ ਪਾਇਆ ਜੀ ਆਪਣਾ ਗੁਰਦਾਸਪੁਰ ਹੀ ਹਾਂਜੀ ਵਧੀਆ ਸਕੂਲ ਠੀਕ ਹੈ ਟੀਚਰ ਸਾਰੇ ਹੈਗੇ ਆ ਬੱਚੇ ਵਧੀਆ ਪੜ੍ਹਦੇ ਆ ਮੇਰੀ ਬੇਟੀ ਹੀ ਇ ਪਹਿਲੀ ਕਲਾਸ 'ਚ ਆ ਵਧੀਆ ਦੇਖੋ ਜਿੱਥੇ ਸਾਡਾ ਹੈਗਾ ਉਹ ਵੀ ਵਧੀਆ ਉਸ ਤੋਂ ਵਧੀਆ ਵਧੀਆ ਵੀ ਸਕੂਲ ਹੈਗਾ ਮਗਰ ਉੱਥੇ ਫੀਸਾਂ ਬੜੀਆਂ

ਸਰਕਾਰੀ ਸਕੂਲ ਵੀ ਵਧੀਆ ਜੀ ਆਪਣੇ ਪਿੰਡ ਵਾਲਾ ਸਕੂਲ ਬੜਾ ਵਧੀਆ ਸਰਕਾਰੀ ਇੰਗਲਿਸ਼ ਮੀਡੀਅਮ ਆ ਗਏ ਦਾ ਉੱਥੇ ਹਾਂਜੀ ਹਾਂਜੀ ਨਾਲ ਵਰਦੀਆਂ ਲੱਗੀਆਂ ਉੱਥੇ ਨਿਆਣਿਆਂ ਨੂੰ ਬੁੱਕਾਂ ਉੱਥੇ ਮਿਲਦੀਆਂ ਸਾਰਾ ਕੁਝ ਉੱਥੇ ਹੀ ਹਾਂਜੀ ਐਡਮਿਸ਼ਨ ਦਾ ਕੋਈ ਚੱਕਰ ਨਹੀਂ ਬਸ ਇਹ ਹੈ ਵੀ ਐਡਮਿਸ਼ਨ ਤਿੰਨ ਹਜ਼ਾਰ ਰੁਪਏ ਲੱਗਣੀ ਹੈ ਅਤੇ ਜਿਹੜੀ ਮਹੀਨੇ ਦੀ ਫੀਸ ਆ ਉਹ ਆਪਣੀ ਗਿਆਰਾਂ ਸੌ ਰੁਪਇਆ ਆ ਪਹਿਲੀ ਕਲਾਸ ਦੀ ਆ ਬਾਕੀ ਕਲਾਸਾਂ ਦੀ ਅਲੱਗ ਅਲੱਗ ਹੋਵੇਗੀ ਹਾਂਜੀ ਅਤੇ ਬਾਕੀ ਟਰਾਂਸਪੋਰਟ ਦਾ ਵੀ ਉਹਨਾਂ ਦਾ ਆਪਣਾ ਹੈਗਾ ਬਸ ਤੁਸੀਂ ਫੀਸ ਦੇ ਦੇਣੀ ਹੈ ਉਹਨਾਂ ਨੂੰ ਟ੍ਰਾਂਸਪੋਰਟ ਦੇ ਪੈਸੇ ਦੇ ਦੇਣੇ ਆ ਤੁਸੀਂ ਦੱਸੋ ਜੀ ਤੁਸੀਂ ਦੱਸੋ ਤੁਸੀਂ ਕਿੱਥੇ ਪਾਉਣਾ ਤੁਸੀਂ ਦੱਸ ਦੋ ਸਰਕਾਰੀ ਪਾਉਣਾ ਪ੍ਰਾਈਵੇਟ ਪ੍ਰਾਈਵੇਟ ਹੀ ਪਾ ਲਓ ਸਾਡੇ ਵਾਲੇ ਕੋਲ ਹੀ ਸਕੂਲ ਹੀ ਪਾ ਲਓ ਬੱਚੇ ਇਕੱਠੇ ਚੱਲ ਜਾਣਗੇ ਹਾਂਜੀ ਹਾਂਜੀ ਨਾਲ ਉੱਥੇ ਟਰਾਂਸਪੋਰਟ ਦਾ ਠੀਕ ਹੈ ਨਾਲ ਟਰਾਂਸਪੋਰਟ ਦਾ ਠੀਕ ਹੈ ਸਕੂਲ ਵੀ ਵੱਡਾ ਸੀ ਬੀ ਐਸ ਈ ਬੋਰਡ ਆ ਟੈਂਸ਼ਨ ਕੋਈ ਨਹੀਂ ਹਾਂਜੀ ਹਾਂਜੀ ਕੋਈ ਨਹੀਂ ਜ਼ਰੂਰ ਜ਼ਰੂਰ ਮਿਲੋ ਮਿਲੋ ਠੀਕ ਸਤਿ ਸ਼੍ਰੀ ਅਕਾਲ